ਸਤਿ ਸ਼੍ਰੀ ਅਕਾਲ ਜੀ ਮੈਂ ਹਰਜੀਤ ਕੌਰ ਪਠਾਨਕੋਟ ਤੋਂ ਬੋਲ ਰਹੀ ਹਾਂ ਮੈਨੂੰ ਕੁਕਿੰਗ ਦਾ ਸ਼ੁਰੂ ਤੋਂ ਹੀ ਬਹੁਤ ਸ਼ੌਂਕ ਹੈ ਜਿਸ ਵਿੱਚ ਮ ਜੋ ਕਿ ਮੈਂ ਵੱਖ ਵੱਖ ਤਰ੍ਹਾਂ ਦੇ ਖਾਣਾ ਬਣਾ ਲੈਂਦੀ ਹਾਂ ਜਿਸ ਤਰ੍ਹਾਂ ਮੇਰੇ ਰਿਸ਼ਤੇਦਾਰ ਕੋਈ ਘਰ ਆਵੇ ਉਹ ਮੇਰਾ ਖਾਣਾ ਬਹੁਤ ਪਸੰਦ ਕਰਦੇ ਆਸ ਪਾਸ ਦੇ ਲੋਕ ਵੀ ਜੋ ਮੇਰਾ ਖਾਣਾ ਖਾਂਦੇ ਨੇ ਬਹੁਤ ਪਸੰਦ ਕਰਦੇ ਨੇ ਜਿਸ ਤਰ੍ਹਾਂ ਕਿ ਮੈਨੂੰ ਜਿਸ ਤਰ੍ਹਾਂ ਕਿ ਮੈਂ ਮਤਲਬ ਕਿ ਇਹਨਾਂ ਵਿੱਚੋਂ ਕਈ ਤਰ੍ਹਾਂ ਦੇ ਪਕਵਾਨ ਜਿਸਦੇ ਮਿੱਠੇ ਚੌਲ ਬੈਂਗਣ ਦਾ ਭੜਥਾ ਰਾਜਮਾਂਹ ਚਾਵਲ ਕਈ ਤਰ੍ਹਾਂ ਦੇ ਪਕਵਾਨ ਜਿਹੜੇ ਆ ਉਹ ਮੈਂ ਬਣਾਉਂਦੀ ਹਾਂ ਜੋ ਮ ਬਾਹਰੋਂ ਵੀ ਆਉਂਦੇ ਨੇ ਕੋਈ ਖਾਸ ਤਰ੍ਹਾਂ ਦੇ ਲੋਕ ਵੀ ਆਉਂਦੇ ਨੇ ਸਾਡੇ ਘਰ ਉਹ ਵੀ ਮੇਰਾ ਖਾਣਾ ਖਾ ਕੇ ਬਹੁਤ ਪਸੰਦ ਕਰਦੇ ਨੇ ਜਿਸ ਤਰ੍ਹਾਂ ਮਿੱਠੇ ਚੌਲ ਮੈਂ ਬਣਾਉਂਦੀ ਹਾਂ ਉਹਨਾਂ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਚੌਲਾਂ ਨੂੰ ਉਬਾਲ ਕੇ ਚੌਲ ਬਣਾ ਸਭ ਤੋਂ ਪਹਿਲਾਂ ਪਾਣੀ ਪਾ ਕੇ ਚੌਲ ਪਾ ਕੇ ਉਹਨਾਂ 'ਚ ਕਲਰ ਪਾ ਕੇ ਚੌਲਾਂ ਨੂੰ ਉਬਾਲ ਕੇ ਉਹਨਾਂ ਨੂੰ ਉਹਨਾਂ ਦੀ ਪਿੱਛ ਨਿਚੋੜ ਕੇ ਉਸ ਤੋਂ ਬਾਅਦ ਉਹਨਾਂ ਨੂੰ ਦੇਸੀ ਘਿਓ ਦਾ ਤੜਕਾ ਲਗਾਉਂਦੇ ਹਾਂ ਜਿਸ ਤਰ੍ਹਾਂ ਦੇਸੀ ਘਿਉ ਪਾ ਕੇ ਉਸਦੇ ਵਿੱਚ ਥੋੜ੍ਹਾ ਡਰਾਈ ਫਰੂਟ ਪਾ ਕੇ ਡਰਾਈ ਫਰੂਟ ਤੋਂ ਬਾਅਦ ਚੌਲਾਂ ਨੂੰ ਵਿੱਚ ਸੁੱਟ ਕੇ ਉਸ ਤੋਂ ਬਾਅਦ ਉਹਨ ਉਹਨਾਂ ਨੂੰ ਥੋੜ੍ਹਾ ਮਿਕਸ ਕਰਕੇ ਉਸ ਵਿੱਚ ਚੀਨੀ ਪਾ ਕੇ ਅਤੇ ਉਹਨਾਂ ਨੂੰ ਥੋੜ੍ਹੀ ਦੇਰ ਲਈ ਢੱਕ ਦਿੰਦੇ ਹਾਂ ਜੋ ਕਿ ਬਾਅਦ ਵਿੱਚ ਦਹੀਂ ਦੇ ਨਾਲ ਸਾਰੇ ਬੜੇ ਖੁਸ਼ ਹੋ ਕੇ ਖਾਂਦੇ ਹਨ